ਸਾਡੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸਾਫ ਰੱਖਣ ਲਈ ਸਭ ਤੋਂ ਪਹਿਲਾਂ ਸਾਨੂੰ ਗੰਦੇ ਪਾਣੀ ਦੀ ਨਿਕਾਸੀ ਬਾਰੇ ਸੋਚਣਾ ਪਏਗਾ ਕਿਉਂਕਿ ਜੇ ਗੰਦਾ ਪਾਣੀ ਸਾਡੇ ਆਲੇ ਦੁਆਲੇ ਵਾਤਾਵਰਨ ਵਿੱਚ ਰਹੇਗਾ ਤਾਂ ਉਸਦੇ ਨਾਲ ਨਾਲ ਉਹ ਡੇਂਗੂ ਮਲੇਰੀਆ ਜੇ ਡੇਂਗੂ ਮਲੇਰੀਆ ਵਾਲੀ ਖਤਰਨਾਕ ਬਿਮਾਰੀਆਂ ਨੂੰ ਵੀ ਜਨਮ ਦਵੇਗਾ ਜਿਹਦੇ ਨਾਲ ਨਾਲ ਉਸ ਦਾ ਅਸਰ ਸਾਡੇ ਵਾਤਾਵਰਨ ਵਿੱਚ ਰਹਿ ਰਹੀ ਜਨਸੰਖਿਆ ਉੱਪਰ ਬਹੁਤ ਹੀ ਬੁਰੀ ਤਰੀਕੇ ਨਾਲ ਪਵੇਗਾ ਅਤੇ ਸਾਨੂੰ ਆਸ ਪਾਸ ਸਫਾਈਆਂ ਵੀ ਰੱਖਣੀਆਂ ਚਾਹੀਦੀਆਂ ਹਨ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਕੇ ਸਾਨੂੰ ਜੂਟ ਦੇ ਬੈਗਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਵਾਤਾਵਰਨ ਵਿੱਚ ਅਧਿਕ ਤੋਂ ਅਧਿਕ ਰੁੱਖ ਲਾਉਣੇ ਚਾਹੀਦੇ ਹਨ ਇਸ ਨਾਲ ਹੀ ਸਾਨੂੰ ਹਫਤੇ ਦੇ ਹਫਤੇ ਇਹ ਸਾਰੀਆਂ ਜਾਣਕਾਰੀਆਂ ਨੂੰ ਇੱਕ ਸੈਮੀਨਾਰ ਦਾ ਰੂਪ ਦੇ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਧੰਨਵਾਦ